ਹੈਲੋ ਹਾਂਜੀ ਹਾਂਜੀ ਹਾਂਜੀ ਮੈਂ ਅੰਜੂ ਬਾਲਾ ਹੀ ਬੋਲ ਰਹੀ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਹਾਂਜੀ ਹਾਂਜੀ ਜੀ ਕੰਪਨੀਆਂ ਤਾਂ ਜੀ ਮੇਰੀ ਗੱਲ ਸੁਣੋ ਬਹੁਤ ਸਾਰੀਆਂ ਕੰਪਨੀਆਂ ਜਿਨ੍ਹਾਂ ਦੇ ਨਾਮ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਹੈ ਨਾ ਅਤੇ ਜਿਵੇਂ ਸਬਜ਼ੀਆਂ ਲਈ ਵੀ ਬਹੁਤ ਸਾਰੀਆਂ ਰੇਹਾਂ ਸਪ੍ਰੇਆਂ ਅਤੇ ਉਹਨਾਂ ਲਈ ਵੀ ਅਲੱਗ ਅਲੱਗ ਕੰਪਨੀਆਂ ਹਨ ਜਿਵੇਂ ਨਰਮਾ ਅਤੇ ਝੋਨਾ ਲਈ ਵੀ ਅਲੱਗ ਅਲੱਗ ਕੰਪਨੀਆਂ ਹਨ ਅਤੇ ਉਹਨਾਂ ਦੀ ਅਲੱਗ ਅਲੱਗ ਰੇਂਜ ਨੇ ਜਿਵੇਂ ਸਬਜ਼ੀਆਂ ਦੀ ਆਪਾਂ ਗੱਲ ਕਰ ਲਈਏ ਤਾਂ ਉਹਨਾਂ ਦੀ ਸਟਾਰਟਿੰਗ ਰੇਂਜ ਚਾਰ ਹਜ਼ਾਰ ਰੁਪਏ ਤੋਂ ਹੈਗੀ ਆ ਅਤੇ ਜਿਵੇਂ ਨਰਮੇ ਅਤੇ ਝੋਨੇ ਦੀ ਹਾਂਜੀ ਹਾਂਜੀ ਹਾਂਜੀ ਮੈਂ ਤੁਹਾਡੀ ਗੱਲ ਸਮਝਦੀ ਹਾਂ ਜੀ ਤੁਹਾਨੂੰ ਵੀ ਪਤਾ ਵੀ ਅੱਜ ਕੱਲ੍ਹ ਮਹਿੰਗਾਈ ਕਿੰਨੀ ਹੋ ਗਈ ਹੈ ਨਾ ਵੀ ਹ ਸਰਕਾਰਾਂ ਨੇ ਹਰੇਕ ਚੀਜ਼ ਦਾ ਰੇਟ ਚੱਕਤਾ ਉੱਤੋਂ ਉਹਨਾਂ 'ਤੇ ਵੀ ਦੁਕਾਨਾਂ 'ਤੇ ਕਈ ਤਰ੍ਹਾਂ ਦੇ ਟੈਕਸ ਵੀ ਲਗਾ ਤੇ ਆ ਵੀ ਜਿਹੜੇ ਉਹ ਸਾਨੂੰ ਭਰਨੇ ਪੈਂਦੇ ਅਤੇ ਹੋਰ ਬਹੁਤ ਤਰ੍ਹਾਂ ਦੇ ਟੈਕਸ ਹੁੰਦੇ ਆ ਜਿਨ੍ਹਾਂ ਕਾਰਨ ਵੀ ਇਹਨਾਂ ਚੀਜ਼ਾਂ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਹਾਂਜੀ ਉਹਨਾਂ ਦੀ ਰੇਂਜ ਸੱਤ ਹਜ਼ਾਰ ਤੋਂ ਸਟਾਰਟਿੰਗ ਆ ਜੀ ਹਾਂਜੀ ਹਾਂਜੀ ਉਹ ਮੈਂ ਤੁਹਾਨੂੰ ਉਹ ਗੱਲ ਤਾਂ ਤਾਂ ਹੀ ਕਹੀ ਆ ਨਾ ਜੀ ਇੱਕ ਤਾਂ ਵੀ ਰੇਟ ਬਹੁਤ ਜ਼ਿਆਦਾ ਇੱਕ ਜਿਵੇਂ ਆਪਾਂ ਕਹਿ ਦਈਏ ਵੀ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈਗੀ ਹੈ ਅਤੇ ਜਿਹੜੀਆਂ ਆਪਣੀਆਂ ਫਸਲਾਂ ਉਹ ਰੇਹਾਂ ਸਪ੍ਰੇਹਾਂ 'ਤੇ ਹੀ ਖੜ੍ਹੀਆਂ ਹੈਗੀਆਂ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਮੀਂਹ ਮੂੰਹ ਬਹੁਤ ਘੱਟ ਆਉਂਦਾ ਹੈਗਾ ਅਤੇ ਲੋਕਾਂ ਨੇ ਤਾਂ ਫਸਲਾਂ ਬੀਜਣੀਆਂ ਹੀ ਹੈਗੀਆਂ ਅਤੇ ਉਹਨਾਂ ਨੂੰ ਜ਼ਿਆਦਾ ਝਾੜ ਚਾਹੀਦਾ ਇਸ ਲਈ ਆਪਾਂ ਰੇਹਾਂ ਸਪ੍ਰੇਹਾਂ ਦੀ ਲੋਕ ਬਹੁਤ ਜ਼ਿਆਦਾ ਵਰਤੋਂ ਕਰਦੇ ਜਿਨ੍ਹਾਂ ਕਾਰਨ ਜਿਹੜੀ ਚੀਜ਼ ਦੀ ਰੇਹ ਜਿਹੜੀ ਚੀਜ਼ ਦੀ ਆਪਣੇ ਜੇ ਆਪਾਂ ਕਹਿ ਦਈਏ ਵੀ ਮਾਰਕੀਟ 'ਚ ਜ਼ਿਆਦਾ ਖਰੀਦਦਾਰ ਹੋਣਗੇ ਉਹਦੀ ਰੇਟ ਤਾਂ ਆਪੋ ਵੀ ਮੱਲੋ ਜ਼ੋਰੀ ਹੈ ਵੀ ਵੱਧ ਹੀ ਹੋਣਗੇ ਉਹ ਵੱਧ ਹੀ ਹੋਊਗਾ ਹਾਂਜੀ ਉਹ ਕੋਈ ਨਾ ਜੀ ਦੋ ਤਿੰਨ ਸੌ ਰੁਪਈਆ ਲੈੱਸ ਹੋ ਸਕਦਾ ਪਰ ਜ਼ਿਆਦਾ ਨਹੀਂ ਹੋ ਸਕਦਾ ਜੀ ਹਾਂਜੀ ਹਾਂਜੀ ਕੋਈ ਨਾ ਤੁਸੀਂ ਆਇਓ ਸ਼ੌਪ 'ਤੇ ਵਧੀਆ ਚਾਹ ਪਾਣੀ ਪੀ ਕੇ ਜਾਇਓ ਵੱਖ ਵੱਖ ਕੰਪਨੀ ਦੀਆਂ ਰੇਹਾਂ ਸਪ੍ਰੇਹਾਂ ਬਾਰੇ ਤੁਹਾਨੂੰ ਦੱਸਾਂਗੇ ਸਾਰੀ ਨੌਲੇਜ ਦੇਵਾਂਗੇ ਉਹ ਤੁਹਾਡੇ 'ਤੇ ਡਿਪੈਂਡ ਆ ਤੁਸੀਂ ਖਰੀਦਣੀ ਆ ਕਿ ਨਹੀਂ ਖਰੀਦਣੀ ਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜਦੋਂ ਮਰਜ਼ੀ ਆਓ ਖੁੱਲ੍ਹੀ ਆ ਦੁਕਾਨ ਤੁਹਾਡੇ ਲਈ ਠੀਕ ਹੈ ਜੀ ਓਕੇ ਓਕੇ ਠੀਕ